ਸਾਡੇ ਪੰਜਾਬ ਦੇ ਵਿੱਚ ਵਿਆਹ ਨੂੰ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਅਹਿਮ ਰੋਲ ਲਾੜੇ ਦਾ ਅਤੇ ਲਾੜੀ ਦਾ ਰਹਿੰਦਾ ਹੈ ਵਿਚੋਲਿਆਂ ਦੀ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਰਿਸ਼ਤੇਦਾਰ ਭੈਣ ਭਾਈ ਸਾਕ ਸੰਬੰਧੀ ਜੋ ਇਸ ਖੁਸ਼ੀ ਦੀ ਘੜੀ ਦੇ ਵਿੱਚ ਸ਼ਾਮਿਲ ਹੁੰਦੇ ਹਨ ਉਹਨਾਂ ਸਾਰਿਆਂ ਦਾ ਵੱਖ ਵੱਖ ਪੱਧਰ 'ਤੇ ਵਿਆਹ ਦੇ ਵਿੱਚ ਸਮਾਗਮ ਦੇ ਵਿੱਚ ਰੋਲ ਹੁੰਦਾ ਹੈ ਸਾਰੇ ਹੀ ਰਿਸ਼ਤੇਦਾਰ ਭੈਣ ਭਾਈ ਸਾਕ ਸੰਬੰਧੀ ਲਾੜੀ ਨੂੰ ਵਿਸ਼ੇਸ਼ ਤੋਹਫੇ ਭੇਂਟ ਕਰਦੇ ਹਨ ਅਦਾ ਕੀਤੇ ਹੋਏ ਤੋਹਫਿਆਂ ਨੂੰ ਲਾੜੀ ਅਤੇ ਲਾੜੀ ਦੇ ਪਰਿਵਾਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਲਿਆ ਜਾਂਦਾ ਹੈ ਅਤੇ ਉਹਨਾਂ ਦੇ ਆਦਰ ਮਾਣ ਦੇ ਵਿੱਚ ਵਾਧਾ ਹੁੰਦਾ ਹੈ ਲਾੜੀ ਨੂੰ ਵਿਆਹ ਦੇ ਵਿੱਚ ਆਪਣੇ ਪਰਿਵਾਰ ਵੱਲੋਂ ਦਾਜ ਦੇ ਵਿੱਚ ਪੇਟੀ ਅਲਮਾਰੀ ਦਰੀਆਂ ਗਦੈਲੇ ਖੇਸ ਬੰਬਲ ਵੱਟੇ ਕੰਬਲ ਭੜੋਲੀਆਂ ਪੱਖੀਆਂ ਆਦਿ ਦਾਜ ਦੇ ਵਿੱਚ ਦਿੱਤੇ ਜਾਂਦੇ ਹਨ ਜੋ ਕਿ ਉਸਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਬੜੀਆਂ ਕੰਮ ਆਉਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਜਿਸ ਨੂੰ ਉਹ ਆਪਣੇ ਸਹੁਰੇ ਪਰਿਵਾਰ ਲੈ ਕੇ ਜਾਂਦੀ ਹੈ ਕਈ ਥਾਈਂ ਵੱਡੇ ਪਰਿਵਾਰਾਂ ਦੇ ਵਿੱਚ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਹਨ ਹੋਰ ਕਈ ਤੋਹਫੇ ਸਾਕ ਸੰਬੰਧੀਆਂ ਵੱਲੋਂ ਦਿੱਤੇ ਜਾਂਦੇ ਹਨ